ਜੇ ਪੰਜਾਬ ਦੇ ਇਤਿਹਾਸ 'ਤੇ ਝਾਤੀ ਮਾਰੀ ਜਾਵੇ ਤਾਂ ਦੇਖਣ ਨੂੰ ਜਾਂਦਾ ਵੈ ਕਿ ਸ਼ੁਰੂ ਤੋਂ ਹੀ ਜਿਹੜੇ ਸਾਡੇ ਇੱਥੇ ਸਾਰੇ ਹਿੰਦੂ ਸਿੱਖ ਮੁਸਲਮਾਨ ਇਕੱਠੇ ਹੀ ਰਹਿੰਦੇ ਆਏ ਹਾਂ ਆਪਸ 'ਚ ਬੜਾ ਵਿਚਰਦੇ ਨੇ ਆਪਸ 'ਚ ਇੱਕ ਦੂਸਰੇ ਦੇ ਘਰ ਆਉਣ ਜਾਣ ਜਾਂ ਹਰ ਤਰ੍ਹਾਂ ਦੇ ਇੱਕ ਦੂਜੇ ਦੇ ਤਿਉਹਾਰਾਂ ਵਿੱਚ ਸਾਂਝ ਇੱਕ ਦੂਸਰੇ ਦੇ ਦੁੱਖ ਸੁੱਖ 'ਚ ਸਾਂਝ ਇੱਕ ਦੂਸਰੇ ਦੇ ਆਉਣਾ ਜਾਣਾ ਮਿਲਣਾ ਵਰਤਣਾ ਔਰ ਈਵਨ ਕੰਮਾਂ ਵਿੱਚ ਵੀ ਜਿਹੜੇ ਜਿਹੜੇ ਆਪਾਂ ਬਿਜ਼ਨਸ ਹੋਏ ਕਾਰੋਬਾਰ ਹੋਵੇ ਕੋਈ ਦੁਕਾਨਦਾਰੀ ਜਾਂ ਕਿਸ ਤਰ੍ਹਾਂ ਉਹ ਰਲ਼ ਮਿਲ ਕੇ ਕਰਦੇ ਹਿੰਦੂ ਦਾ ਸਿੱਖ ਨਾਲ਼ ਜਾਂ ਹਿੰਦੂ ਦਾ ਮੁਸਲਮਾਨ ਨਾਲ਼ ਸਿੱਖ ਦਾ ਮੁਸਲਮਾਨ ਜਾਂ ਇਸ ਤਰ੍ਹਾਂ ਦੇਖੇ ਹੋਏ ਅਤੇ ਕਿਸੇ ਨੂੰ ਇਸ ਚੀਜ਼ ਵੱਲ ਧਿਆਨ ਹੀ ਨਹੀਂ ਹੁੰਦਾ ਕਿ ਕਿਸੇ ਦਾ ਧਰਮ ਜਾਂ ਕਿਸੇ ਦਾ ਕੀ ਹੈ ਆਪਸੀ ਬਸ ਲਗਾਵ ਪ੍ਰੇਮ ਹ ਹੋਣ ਕਰਕੇ ਉਹ ਆਪਣੇ ਸਾਰੇ ਕੰਮ ਸਾਂਝ ਦੇ ਤੌਰ 'ਤੇ ਚੱਲੀ ਜਾ ਰਹੇ ਆ ਸ਼ੁਰੂ ਤੋਂ ਦੇਖਦੇ ਆ ਰਹੇ ਆ ਹਾਂ ਕਿਤੇ ਕਿਸੇ ਵੇਲੇ ਕੋਈ ਪੋਲੀ ਪੋਲੀਟੀਕਲ ਜੇ ਬੋਲੇ ਗ਼ਲਤ ਕੋਈ ਇਸ ਤਰ੍ਹਾਂ ਭਾਵਨਾਵਾਂ ਪੈਦਾ ਕੀਤੀਆਂ ਜਾਂਦੀਆਂ ਜਾਂ ਕਦੀ ਕੋਈ ਭੜਕਾਊ ਕੰਮ ਹੋ ਜਾਂਦੇ ਆ ਕਈ ਵਾਰੀ ਇਹ ਤੇ ਚਲੋ ਇਤਿਹਾਸ ਦੇਖਣ 'ਚ ਆਉਂਦਾ ਲੇਕਿਨ ਵੇਖਿਆ ਜਾਵੇ ਤਾਂ ਆਮ ਜਿਹੜੀ ਜਨਤਾ ਹੈ ਉਹਨੂੰ ਇਹਨਾਂ ਚੀਜ਼ਾਂ ਨਾਲ਼ ਕੋਈ ਬਹੁਤਾ ਮਤਲਬ ਨਹੀਂ ਹੁੰਦਾ ਉਹਨਾਂ ਨੂੰ ਕਿ ਜਿਹੜੇ ਦੋ ਬੰਦੇ ਜੇ ਕੋਈ ਸਿੱਖ ਹਿੰਦੂ ਇਕੱਠੇ ਮਿਲ ਕੇ ਕੁਛ ਕੰਮ ਕਰ ਰਹੇ ਅਤੇ ਉਹਨਾਂ ਨੂੰ ਇੱਕ ਦੂਸਰੇ ਪ੍ਰਤੀ ਇਸ ਤਰ੍ਹਾਂ ਕਦੇ ਫੀਲ ਹੁੰਦਾ ਹੀ ਨਹੀਂ ਉਹ ਆਪਣਾ ਕੰਮ ਪੂਰੇ ਉਸ ਤਰ੍ਹਾਂ ਇੱਕ ਦੂਸਰੇ ਦੇ ਦੁੱਖ ਸੁੱਖ ਦੀ ਸਾਂਝ ਵਿੱਚ ਵੀ ਇੱਕ ਦੂਸਰੇ ਦੇ ਕੰਮ ਆਉਂਦੇ ਆ ਜੇ ਕਿਸੇ ਨੂੰ ਪਤਾ ਚੱਲਦਾ ਕਿ ਇਹਦੇ ਆਹ ਇੱਕ ਦੂਸਰੇ ਦੇ ਭੈਣ ਭਰਾ ਦੇ ਅਤੇ ਜਿਸ ਤਰ੍ਹਾਂ ਕੋਈ ਧੀ ਭੈਣ ਦਾ ਕੋਈ ਵਿਆਹ ਸ਼ਾਦੀ ਹੋਵੇ ਜਾਂ ਕੋਈ ਜਾਂ ਕੋਈ ਦੁੱਖ ਸੁੱਖ ਉੱਥੇ ਵੀ ਬੜੀ ਇੱਕ ਦੂਸਰੇ ਦੀ ਹੈਲਪ ਕਰਦੇ ਆ ਕਾਰੋਬਾਰ ਰਿਸ਼ਤੇ ਦੇ ਕਾਫ਼ੀ ਸਾਰੇ ਕਾਰੋਬਾਰਾਂ ਦੀ ਸਾਂਝ ਸ਼ੁਰੂ ਤੋਂ ਚੱਲੀਆਂ ਆ ਰਹੀਆਂ ਪੁਰਾਣੀਆਂ ਤੋਂ ਪੁਰਾਣੀਆਂ ਵੀ ਔਰ ਮਾਹੌਲ ਵਿੱਚ ਕਿਸ ਤਰ੍ਹਾਂ ਦੀ ਪੋਲੀਟੀਕਲ ਪ੍ਰਭਾਵ ਆਉਣ 'ਤੇ ਵੀ ਕਈਆਂ ਨੂੰ ਤਾਂ ਬਹੁਤ ਫ਼ਰਕ ਨਹੀਂ ਬਿਲਕੁਲ ਵੀ ਪੈਂਦਾ ਇਹ ਮਤਲਬ ਪੰਜਾਬ ਦਾ ਇਤਿਹਾਸ ਇਸ ਤਰ੍ਹਾਂ ਦਾ ਹੀ ਇੱਕ ਰਲ਼ਿਆ ਮਿਲਿਆ ਇਤਿਹਾਸ ਰਿਹਾ ਵੈ